ਪੰਜਾਬ ਵਿੱਚ ਬਹੁਤ ਸਾਰੀਆਂ ਸਰਕਾਰੀ ਸਕੀਮਾਂ ਚੱਲ ਰਹੀਆਂ ਹਨ ਜਿਵੇਂ ਕਿ ਟੀਕਾਕਰਨ ਅਭਿ ਅਭਿਆਨ ਹੋ ਗਿਆ ਪੋਲੀਓ ਡਰੋਪਸ ਵਾਲਾ ਹੋ ਗਿਆ ਕਿ ਆਹ ਸਾਰੇ ਬੱਚਿਆਂ ਨੂੰ ਘਰ ਜੇ ਕੋਈ ਨਹੀਂ ਵੀ ਜਾਂਦਾ ਤਾਂ ਘਰ ਘਰ ਜਾ ਕੇ ਉਹ ਸਭ ਦੇ ਪੁੱਛ ਕੇ ਵੀ ਜਿਹੜਾ ਕੋਈ ਰਹਿ ਗਿਆ ਤਾਂ ਉਹਨਾਂ ਦੇ ਡਰੋਪਸ ਦੇ ਕੇ ਆਉਂਦੇ ਆ ਬੱਚਿਆਂ ਨੂੰ ਤਾਂ ਕਿ ਆਪਣੇ ਦੇਸ਼ 'ਚੋਂ ਅਪਾਹਿਜਤਾ ਅਤੇ ਅਪੰਗਤਾਂ ਖ਼ਤਮ ਹੋ ਸਕੇ ਅਤੇ ਹੋਰ ਹੋਰ ਸਕੀਮਾਂ ਚੱਲ ਰਹੀਆਂ ਵੀ ਜਿਨਾਂ ਕੋਲ ਆਪਣੇ ਆਪਣੇ ਘਰ ਨਹੀਂ ਸੀਗੀ ਜਿਲਜੁਲ ਜਗਾ ਹੈਗੀ ਸੀ ਤਾਂ ਉਹਨਾਂ ਨੂੰ ਘਰ ਪਾਉਣ ਵਾਸਤੇ ਵੀ ਸਹੂਲਤਾਂ ਮਿਲ ਰਹੀਆਂ ਹਨ ਅਤੇ ਮੁਫ਼ਤ ਇਲਾਜ ਦੀ ਸਕੀਮ ਚੱਲੀ ਹੋਈ ਹੈ ਜਿਨ ਜਿਹੜੇ ਗਰੀਬ ਲੋਕ ਹੈ ਜਿਹੜੇ ਆਪਣਾ ਇਲਾਜ ਨਹੀਂ ਕਰਵਾ ਸਕਦੇ ਉਹਨਾਂ ਵਾਸਤੇ ਚੱਲੀ ਹੋਈ ਹੈ ਵੀ ਆਪਣਾ ਉਹ ਕਾਰਡ ਬਣਵਾ ਲੈਣ ਅਤੇ ਸਰਕਾਰੀ ਸਕੀਮ ਚੱਲੀ ਹੋਈ ਹੈ ਕਿ ਉਹਨਾਂ ਦਾ ਸਰਕਾਰੀ ਹਸਪਤਾਲ 'ਚ ਫਿਰ ਮੁਫ਼ਤ ਇਲਾਜ ਹੋ ਜਾਂਦਾ ਹੈਗਾ ਉਹਨਾਂ ਦੀ ਪਹੁੰਚ ਨਹੀਂ ਹੁੰਦੀ ਇੰਨੀ ਕਿ ਉਹ ਪ੍ਰਾ ਪ੍ਰਾਈਵੇਟ ਹਸਪਤਾਲਾਂ ਵਿੱਚ ਜਾ ਕੇ ਕਰਵਾ ਸਕਣ ਤਾਂ ਸਰਕਾਰ ਨੇ ਇਹੋ ਜਿਹੀਆਂ ਸਕੀਮਾਂ ਚਲਾਈਆਂ ਹਨ ਵੀ ਉਹ ਆਪਣਾ ਕੋਈ ਜੇ ਵੱਡੀ ਬਿਮਾਰੀ ਲੱਗਦੀ ਹੈ ਤਾਂ ਸਰਕਾਰੀ ਹਸਪਤਾਲਾਂ 'ਚ ਜਾ ਕੇ ਇਲਾਜ ਕਰਵਾ ਸਕਣ ਨਾਲ ਹੁਣ ਇੱਕ ਇਹ ਸਹੂਲੀਅਤ ਵੀ ਹੈ ਕਿ ਸਰਕਾਰੀ ਹਸਪਤਾਲਾਂ ਵਿੱਚ ਪਹਿਲਾਂ ਦਵਾਈ ਬਾਹਰੋਂ ਲਿਖ ਕੇ ਦਿੰਦੇ ਸੀ ਹੁਣ ਦਵਾਈਆਂ ਵੀ ਅੰਦਰੋਂ ਮਿਲਦੀਆਂ ਹੈ ਜਿਹੜੇ ਗਰੀਬ ਲੋਕ ਆ ਉਹਨਾਂ ਨੂੰ ਬਹੁਤ ਇਹਦੇ ਨਾਲ ਫ਼ਾਇਦਾ ਹੋਇਆ ਹੈ ਕਿਉਂਕਿ ਉਹਨਾਂ ਦੀ ਇੰਨੀ ਕਮਾਈ ਦਾ ਸਾਧਨ ਇੰਨੀ ਨਹੀਂ ਹੁੰਦੀ ਕਿ ਉਹ ਵੀ ਇੰਨੀਆਂ ਬਾਹਰੋਂ ਦਵਾਈਆਂ ਲੈ ਸਕਣ ਉਹ ਅਤੇ ਹੋਰ ਹੋਰ ਉਹਨਾਂ ਨੂੰ ਕੀ ਕਹਿੰਦੀ ਹੈ ਮੋਦੀਖਾਨਾ ਵਾਲੀ ਦਵਾਈ ਆਹਾ ਮੈਡੀਕਲ ਖੁੱਲ੍ਹਿਆ ਹੋਇਆ ਜਿੱਥੇ ਦਵਾਈਆਂ ਆਪਾਂ ਨੂੰ ਵੀ ਦੂਜੇ ਦੂਜੇ ਦਵਾਈ ਵਾਲੇ ਮੈਡੀਕਲ ਤੋਂ ਸਸਤੀ ਮਿਲਦੀ ਹੈ ਜਿੱਥੇ ਆਪਾਂ ਨੂੰ ਦਵਾਈ ਵੀ ਆਪਾਂ ਉੱਥੋਂ ਲੈ ਸਕਦੇ ਹਾਂ ਦਵਾਈ